ਸਾਹਿਤ ਕਵਿਤਾ ਅਤੇ ਕਲਾਤਮਕ ਵਿੱਚ ਬਹੁਤ ਸਾਰੇ ਕਵੀ ਹੋਏ ਹਨ ਉਹ ਕਵੀ ਬਹੁਤ ਵਧੀਆ ਕਵਿਤਾ ਲਿਖਦੇ ਹਨ ਅਤੇ ਉਹ ਪੰਜਾਬੀ ਦੀ ਸਹੀ ਵਰਤੋਂ ਕਰਦੇ ਹਨ ਅਤੇ ਜੋ ਕਵਿਤਾ ਲਿਖਦੇ ਹਨ ਉਹਨਾਂ ਨੂੰ ਪੜ੍ਹ ਕੇ ਸਾਨੂੰ ਵਧੀਆ ਮਹਿਸੂਸ ਹੁੰਦਾ ਹੈ ਅਤੇ ਉਹ ਬਹੁਤ ਹੀ ਕਵਿਤਾ ਵਧੀਆ ਹੁੰਦੀਆਂ ਹਨ ਅਤੇ ਸਾਡੇ ਭਵਿੱਖ ਲਈ ਵੀ ਵਧੀਆ ਹੁੰਦੀਆਂ ਹਨ ਪੰਜਾਬੀ ਵਿੱਚ ਬਹੁਤ ਸਾਰੇ ਕਵੀ ਹੋਏ ਹਨ ਜਿਵੇਂ ਕਿ ਸ਼ਿਵ ਕੁਮਾਰ ਬਟਾਲਵੀ ਅੰਮ੍ਰਿਤਾ ਪ੍ਰੀਤਮ ਸੁਰਜੀਤ ਪਾਤਰ ਆਦਿ ਇਹਨਾਂ ਨੇ ਕਈ ਸਾਰੀਆਂ ਕਵਿਤਾ ਲਿਖੀਆਂ ਹਨ ਅਤੇ ਹੀ ਬਹੁਤ ਹੀ ਵਧੀਆ ਕਵਿਤਾ ਲਿਖਦੇ ਹਨ ਅਤੇ ਇਹਨਾਂ ਦੀਆਂ ਕਵਿਤਾ ਮਨ ਭਾਵਕ ਹੁੰਦੀਆਂ ਹਨ ਜਿਨ੍ਹਾਂ ਨੂੰ ਪੜ੍ਹ ਕੇ ਆਨੰਦ ਮਿਲਦਾ ਹੈ ਅਤੇ ਇਹਨਾਂ ਦੀਆਂ ਕਵਿਤਾਵਾਂ ਬਹੁਤ ਹੀ ਮਸ਼ਹੂਰ ਸਨ